ਬਾਈਕਿੰਗ ਲਈ ਮੈਨੂੰ ਜਿਹੜੀ ਚੀਜ਼ ਨੇ ਪ੍ਰੇਰਿਤ ਕੀਤਾ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿ ਸਕਦਾ ਕਿ ਉਹ ਮੇਰੀ ਲੋੜ ਸੀ ਪੁਰਾਣੇ ਟਾਈਮ ਦੇ ਵਿੱਚ ਜਦੋਂ ਮੇਰੇ ਕੋਲ ਸਾਈਕਲ ਸੀ ਤਾਂ ਮੈਂ ਸੋਚਦਾ ਸੀ ਕਿ ਜਦੋਂ ਜਾਣਾ ਬਸ ਸਾਈਕਲ ਤੇ ਚਲੇ ਜਾਵਾਂਗੇ ਪਰ ਹੌਲੀ ਹੌਲੀ ਸਮਾਂ ਚੇਂਜ ਹੁੰਦਾ ਗਿਆ ਸਮੇਂ ਦੇ ਹਿਸਾਬ ਦੇ ਨਾਲ ਮੇਰੇ ਦੋਸਤਾਂ ਨੇ ਮੈਨੂੰ ਕਿਹਾ ਕਿ ਵੀਰ ਤੁਹਾਨੂੰ ਵੀ ਬਾਈਕ ਸਿੱਖ ਲੈਣਾ ਚਾਹੀਦਾ ਅਤੇ ਲੈ ਲੈਣਾ ਚਾਹੀਦਾ ਮੈਂ ਸੋਚਿਆ ਕਿ ਚਲੋ ਮੇਰੇ ਕੋਲ ਸਾਈਕਲ ਹੈ ਤਾਂ ਮੈਂ ਜਿਹੜੀਆਂ ਆਪਦੀਆਂ ਲੋੜਾਂ ਹੈਗੀਆਂ ਉਹ ਸਾਈਕਲ 'ਤੇ ਪੂਰੀਆਂ ਕਰ ਸਕਦਾ ਪਰ ਜਿਸ ਤਰ੍ਹਾਂ ਸਮਾਂ ਚੇਂਜ ਹੁਦਾ ਹੁੰਦਾ ਗਿਆ ਸਮਾਂ ਚੇਂਜ ਹੋਣ ਦੇ ਨਾਲ ਥੋੜ੍ਹੀ ਕਿਸੇ ਟਾਈਮ ਕਿਸੇ ਜਗ੍ਹਾ 'ਤੇ ਜਲਦੀ ਪਹੁੰਚਣਾ ਹੁੰਦਾ ਸੀ ਤਾਂ ਸਾਈਕਲ 'ਤੇ ਸਮਾਂ ਲੱਗ ਜਾਂਦਾ ਸੀ ਫਿਰ ਥੋੜ੍ਹੀ ਮੁਸ਼ਕਲ ਵੀ ਆਉਂਦੀ ਸੀ ਸਾਈਕਲ ਚਲਾਉਣ ਵਿੱਚ ਤਾਂ ਫਿਰ ਕੀ ਹੋਇਆ ਕਿ ਮੈਂ ਆਪਣੇ ਦੋਸਤਾਂ ਤੋਂ ਉਹਨਾਂ ਦੀ ਬਾਈਕ ਤੋਂ ਬਾਇਕ ਸਿੱਖ ਲਈ ਬਾਈਕ ਸਿੱਖ ਲਈ ਫਿਰ ਮੈਂ ਕਾਫੀ ਸਮਾਂ ਬਾਈਕ ਚਲਾਉਂਦਾ ਰਿਹਾ ਜਦੋਂ ਕਿਤੇ ਜਾਣਾ ਹੁੰਦਾ ਸੀ ਤਾਂ ਪਹਿਲਾਂ ਮੈਨੂੰ ਕਿਸੇ ਨੂੰ ਨਾਲ ਲੈ ਕੇ ਜਾਣਾ ਪੈਂਦਾ ਸੀ ਬਾਈਕ 'ਤੇ ਫਿਰ ਮੈਂ ਆਪ ਚਲਾ ਕੇ ਲਿਜਾਣ ਲੱਗ ਗਿਆ ਨਾਲ ਹੀ ਫਿਰ ਮੈਂ ਥੋੜ੍ਹੇ ਸਮੇਂ ਬਾਅਦ ਆਪਣੀ ਨਵੀਂ ਬਾਈਕ ਲੈ ਲਈ ਨਵੀਂ ਬਾਈਕ ਲਈ ਤਾਂ ਜਿਹੜੀਆਂ ਮੇਰੀਆਂ ਲੋੜਾਂ ਸੀਗੀਆਂ ਉਹਨਾਂ ਨੂੰ ਪੂਰਾ ਕਰਨ ਲਈ ਮੈਨੂੰ ਸਮਾਂ ਬੱਚ ਜਾਂਦਾ ਸੀ ਸਮੇਂ ਸਿਰ ਮੈਂ ਆਪਣੇ ਜਿਸ ਜਗ੍ਹਾ 'ਤੇ ਪਹੁੰਚਣਾ ਹੁੰਦਾ ਸੀ ਪਹੁੰਚ ਜਾਂਦਾ ਸੀਗਾ ਅਤੇ ਹੌਲੀ ਹੌਲੀ ਹੌਲੀ ਹੌਲੀ ਇਸ ਤਰ੍ਹਾਂ ਸਮਾਂ ਅੱਗੇ ਲੰਘਦਾ ਗਿਆ ਚਲਾਉਂਦੇ ਗਏ ਸਾਈਕਲ ਤੋਂ ਬਾਈਕ 'ਤੇ ਆ ਗਿਆ ਫਿਰ ਬਾਈਕ ਮੇਰੀ ਰੋਜ਼ਾਨਾ ਦਾ ਰੋਜ਼ਾਨਾ ਦਾ ਇੱਕ ਅੰਗ ਬਣ ਗਿਆ ਜੀਵਨ ਦਾ ਕਿ ਜਦੋਂ ਵੀ ਕਿਤੇ ਜਾਣਾ ਸੀ ਮੈਂ ਬਾਈਕ 'ਤੇ ਜਾਂਦਾ ਅਤੇ ਇਸ ਤਰ੍ਹਾਂ ਹੌਲੀ ਹੌਲੀ ਜਨੂੰਨ ਜਿਹੜਾ ਬਾਈਕ ਚਲਾਉਣ ਦਾ ਸੀ ਉਹ ਵੱਧਦਾ ਗਿਆ ਵਿਕਸਿਤ ਹੋਇਆ ਫਿਰ ਬਾਈਕ ਚਲਾ ਕੇ ਮੈਨੂੰ ਥੋੜ੍ਹਾ ਸਕੂਨ ਵੀ ਮਿਲਦਾ ਸੀ ਸਰੀਰਕ ਮੁਸ਼ਕਲ ਵੀ ਘੱਟ ਆਉਂਦੀ ਸੀ ਮੈਨੂੰ ਅਤੇ ਜਿਸ ਜਗ੍ਹਾ 'ਤੇ ਮੈਂ ਪਹੁੰਚਣਾ ਹੁੰਦਾ ਸੀ ਮੈਂ ਜਲਦੀ ਪਹੁੰਚ ਜਾਂਦਾ ਸੀਗਾ ਅਤੇ ਮੇਰਾ ਸਮਾਂ ਬਚ ਜਾਂਦਾ ਸੀਗਾ ਇਸ ਤਰ੍ਹਾਂ ਮੇਰੇ ਵਿੱਚ ਬਾਈਕ ਚਲਾਉਣ ਦਾ ਵੀ ਜਨੂੰਨ ਵੱਧਦਾ ਗਿਆ ਇੰਟਰਸਟਿਡ ਹੁੰਦਾ ਗਿਆ ਮੈਂ ਬਾਈਕ ਚਲਾਉਣ ਵਿੱਚ